ਪੰਦਰਾਂ ਅਗਸਤ ਸੰਨ ਉੱਨੀ ਸੌ ਸੰਤਾਲੀ ਛੱਬੀ ਜਨਵਰੀ ਸੰਨ ਉੱਨੀ ਸੌ ਪੰਜਾਹ ਸਤਾਰਾਂ ਫਰਬਰੀ ਸੰਨ ਉੱਨੀ ਸ ਸੌ ਇਕੱਤਰ ਛੱਬੀ ਅਗਸਤ ਸੰਨ ਦੋ ਹਜ਼ਾਰ ਦੋ ਤੀਹ ਮਾਰਚ ਸੰਨ ਦੋ ਹਜ਼ਾਰ